ਮੈਂ ਕਢਾਈ ਦੇ ਕਈ ਕਿਸਮ ਦੇ ਡਿਜ਼ਾਇਨ ਕੱਢੇ ਹਨ ਜੋ ਵੱਖ ਵੱਖ ਢੰਗਾਂ ਅਤੇ ਰੂਪਾਂ ਵਿੱਚ ਹੁੰਦੇ ਹਨ ਕਢਾਈ ਕਲਾ ਦੇ ਤਹਿਤ ਹਰ ਰੂਪ ਅਤੇ ਡਿਜ਼ਾਇਨ ਖਾਸ ਹੁੰਦਾ ਹੈ ਜਿਸ ਨੂੰ ਕਲਾਕਾਰ ਆਪਣੇ ਹੱਥ ਕੱਢਦਾ ਹੈ ਜਾਂ ਮਸ਼ੀਨ ਨਾਲ ਵੀ ਕੀਤਾ ਜਾ ਸਕਦਾ ਹੈ ਮੈਂ ਕੁਛ ਬੁਨਿਆਦੀ ਅਤੇ ਕੁਛ ਔਖੇ ਡਿਜ਼ਾਇਨਾਂ ਨੂੰ ਪ੍ਰਯੋਗ ਕੀਤਾ ਹੈ ਜਿਵੇਂ ਫੁੱਲ ਪੱਤਿਆਂ ਵਾਲੀ ਕਢਾਈ ਇਸ ਵਿੱਚ ਫੁੱਲਾਂ ਅਤੇ ਪੱਤੀਆਂ ਦੇ ਸੁੰਦਰ ਡਿਜ਼ਾਇਨ ਬਣਾਏ ਜਾਂਦੇ ਹਨ ਜਿਵੇਂ ਗੁਲਾਬ ਮਨੀ ਮਲੀਆ ਅਤੇ ਕੁਛ ਨੈਚੁਰਲ ਡਿਜਾਇਨਾਂ ਨੂੰ ਹੱਥਾਂ ਨਾਲ ਜਾਂ ਮਸ਼ੀਨਾਂ ਨਾਲ ਕੱਟਣ ਦਾ ਤਰੀਕਾ ਇਹ ਕਾਫੀ ਪ੍ਰਚਲਿਤ ਅਤੇ ਰੰਗ ਬਿਰੰਗੇ ਹੁੰਦੇ ਹਨ ਗਿਆਨ ਪਹਿਨਾਵਾ ਕਢਾਈ ਕਢਾਈ ਨੂੰ ਕੱਢਣ ਦੀ ਇੱਕ ਹੋਰ ਰੂਪ ਜੋ ਗਿਆਨ ਜਾਂ ਕੱਪੜੇ ਦੇ ਵੱਖ ਵੱਖ ਹਿੱਸਿਆਂ ਉੱਤੇ ਕਮਿਊਨਿਟੀ ਡਿਜ਼ਾਇਨਰ ਜਿਵੇਂ ਕਿ ਸਧਾਰਨ ਲਾਈਨਾਂ ਅਤੇ ਪੈਟਰਨ ਨੂੰ ਉਭਾਰਨ ਦੀ ਵਰਤੋਂ ਕੀਤੀ ਜਾਂਦੀ ਹੈ ਜੈਵਿਕ ਡਿਜਾਈਨ ਕਢਾਈ ਦੇ ਇਸ ਰੂਪ ਵਿੱਚ ਕਲਾਕਾਰ ਤਰਲ ਲਾਈਨਾਂ ਜਾਂ ਮਿਤੀ ਆਕਾਰ ਜਾਂ ਅਬਾਕਾਂ ਨੂੰ ਬਣਾਉਂਦਾ ਹੈ ਇਹ ਡਿਜ਼ਾਇਨ ਔਖੇ ਅਤੇ ਸਹੀ ਪ੍ਰਯੋਗ ਕੀਤੇ ਜਾਂਦੇ ਹਨ ਕੱਚੀ ਕਢਾਈ ਪੰਜਾਬੀ ਅਤੇ ਪਾਕਿਸਤਾਨੀ ਕਲਚਰ ਵਿੱਚ ਖਾਸ ਤੌਰ 'ਤੇ ਚਿੱਟੇ ਜਾਂ ਫੁੱਲਦਾਰ ਡਿਜ਼ਾਇਨ ਬਹੁਤ ਪ੍ਰਚਲਿਤ ਹੁੰਦੇ ਹਨ ਜਿਹਨਾਂ ਨੂੰ ਲੰਬੇ ਇਕੱਠੇ ਅਤੇ ਸ਼ੁੱਧ ਪੇਂਟਿੰਗ ਪੈਟਰਨ ਬਣਾਏ ਹੁੰਦੇ ਹਨ ਮੇਰਾ ਪਸੰਦ ਦਾ ਡਿਜਾਇਨ ਫੁੱਲਾਂ ਅਤੇ ਪੱਤੀਆਂ ਵਾਲਾ ਡਿਜਾਇਨ ਹੈ ਇਹ ਸਾਫ ਅਤੇ ਸੁੰਦਰ ਲੱਗਦਾ ਹੈ ਅਤੇ ਕਿਸੇ ਵੀ ਕੱਪੜੇ 'ਤੇ ਕਾਫੀ ਅੰਦਾਜ ਦਿੰਦਾ ਹੈ ਫੁੱਲਾਂ ਦੀ ਕਢਾਈ ਵਿੱਚ ਰੰਗਾਂ ਦੀ ਖੂਬਸੂਰਤ ਵਰਤੋਂ ਅਤੇ ਹਰ ਇੱਕ ਸੁਲਝੇ ਹੋਏ ਪੈਟਰਨ ਨੂੰ ਬਹੁਤ ਵਧੀਆ ਤਰ੍ਹਾਂ ਕੀਤਾ ਜਾਂਦਾ ਹੈ